ਰੁੱਖ ਲਗਾਣਾ ਬਹੁਤ ਹੀ ਵਧੀਆ ਗੱਲ ਹੈ ਰੁੱਖ ਨਾਲ ਸਾਡੀ ਆਕਸੀਜਨ ਦੀ ਮਾਤਰਾ ਵੱਧਦੀ ਹੈ ਜਿਸ ਨਾਲ ਸਾਡਾ ਸਾਹ ਲੈਣਾ ਬਹੁਤ ਹੀ ਸੌਖਾ ਹੋ ਜਾਂਦਾ ਹੈ ਰੁੱਖ ਇੱਕ ਬਹੁਤ ਜ਼ਰੂਰੀ ਹਨ ਅਤੇ ਇਹ ਪੋਲਿਊਸ਼ਨ ਵੀ ਘਟਾਉਂਦੇ ਹਨ ਬਟ ਮੇਰੇ ਗੁਆਂਢ ਵਿੱਚ ਐਸੋਸੀਏਸ਼ਨ ਇੱਕ ਰੁੱਖ ਲਗਾਉਣਾ ਦੀ ਪਹਿਲ ਕਰਮੀ ਕੀ ਯੋਜਨਾ ਬਣਾ ਰਹੀ ਹੈ ਜਿਸ ਕਾਰਨ ਬਹੁਤ ਹੀ ਗੰਦ ਮੱਚਦਾ ਹੈ ਜੋ ਕਿ ਹਰਾ ਗੰਦ ਹੁੰਦਾ ਹੈ ਜਿਸ ਨਾਲ ਮੇਰੇ ਘਰ ਦੇ ਬਾਹਰ ਬਹੁਤ ਹੀ ਕੂੜਾ ਇਕੱਠਾ ਹੋ ਜਾਂਦਾ ਹੈ ਸੋ ਕਿਰਪਾ ਕਰਕੇ ਮੈਂ ਤੁਹਾਨੂੰ ਇਸ ਦੀ ਕੰਪਲੇਂਟ ਕਰਨਾ ਚਾਹੁੰਦਾ ਹਾਂ ਕਿ ਜਲਦੀ ਜਲਦੀ ਇਹ ਹਰਾ ਗੰਦ ਚਕਾਇਆ ਜਾਵੇ ਅਤੇ ਇਹਦੀ ਕੋਈ ਵਧੀਆ ਜੀ ਯੋਜਨਾ ਸੋਚੀ ਜਾਵੇ ਇਹ ਬਹੁਤ ਕੂੜਾ ਉੱਡਦਾ ਹੈ ਅਤੇ ਗੰਦਗੀ ਮਚਾਉਂਦਾ ਹੈ ਜਿਸ ਕਾਰਨ ਕਾਫੀ ਪ੍ਰੋਬਲਮ ਇਕੱਠੀਆਂ ਹੋ ਜਾਂਦੀਆਂ ਹਨ

ਜਦੋਂ ਹਵਾ ਚੱਲਦੀ ਹੈ ਇਹ ਸਾਰੇ ਮੁਹੱਲੇ ਵਿੱਚ ਫੈਲ ਜਾਂਦਾ ਹੈ ਸੋ ਮੈਂ ਤੁਹਾਨੂੰ ਮਯੂਨਿਸਪੈਲਟੀ ਦਫਤਰ ਨਾਲ ਸੰਪਰਕ ਕਰਕੇ ਆਹੀ ਦੱਸਣਾ ਚਾਹੁੰਦਾ ਹਾਂ ਇਹਦਾ ਕੋਈ ਜਲਦ ਤੋਂ ਜਲਦ ਹੱਲ ਕੱਢਿਆ ਜਾਵੇ ਅਤੇ ਇਸ ਦਾ ਕੋਈ ਸਹੀ ਉਪਚਾਰ ਕੀਤਾ ਜਾਵੇ ਇਹ ਮੇਰੀ ਇੱਕ ਛੋਟੀ ਜਿਹੀ ਬੇਨਤੀ ਹੈ